ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੇ ਸੱਭਿਆਚਾਰਿਕ ਅੰਤਰ ਦੇਖਣ ਨੂੰ ਮਿਲਦੇ ਨੇ ਜਿਵੇਂ ਉੱਤਰੀ ਭਾਰਤ ਦੀ ਭਾਸ਼ਾ ਜ਼ਿਆਦਾ ਲਚਕਦਾਰ ਹੁੰਦੀ ਹੈ ਉੱਥੇ ਹੀ ਦੱਖਣੀ ਭਾਰਤ ਦੀ ਭਾਸ਼ਾ ਵਿੱਚ ਲਚਕੀਲਾਪਣ ਇੰਨਾ ਨਹੀਂ ਹੁੰਦਾ ਅਤੇ ਗੁੰਝਲਦਾਰ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਪਹਿਰਾਵੇ ਵਿੱਚ ਵੀ ਕਈ ਤਰ੍ਹਾਂ ਦੇ ਅੰਤਰ ਦੇਖਣ ਨੂੰ ਮਿਲਦੇ ਨੇ ਉੱਤਰੀ ਭਾਰਤ ਦੇ ਵਿੱਚ ਬਾਹਰਲੀਆਂ ਦੇਸ਼ਾਂ ਦਾ ਜ਼ ਵਧੇਰੇ ਪ੍ਰਭਾਵ ਹੈ ਦੱਖਣੀ ਭਾਰਤ ਦੇ ਵਿੱਚ ਬਾਹਰਲੇ ਦੇਸ਼ਾਂ ਦਾ ਪ੍ਰਭਾਵ ਘੱਟ ਹੈ ਜਿੱਥੇ ਉੱਤਰੀ ਭਾਰਤ ਦਾ ਵਾਤਾਵਰਨ ਸਾਲ ਵਿੱਚ ਬਦਲਦਾ ਰਹਿੰਦਾ ਹੈ ਅਤੇ ਤਾਪਮਾਨ ਸਰਦੀਆਂ ਦੇ ਵਿੱਚ ਬਹੁਤ ਘੱਟ ਜਾਂਦਾ ਹੈ ਅਤੇ ਗਰਮੀਆਂ ਦੇ ਵਿੱਚ ਬਹੁਤ ਵੱਧ ਜਾਂਦਾ ਹੈ ਉੱਥੇ ਹੀ ਦੱਖਣੀ ਭਾਰਤ ਦੇ ਵਿੱਚ ਵਾਤਾਵਰਨ ਪੂਰੇ ਸਾਲ ਇੱਕ ਸਮਾਨ ਹੀ ਰਹਿੰਦਾ ਹੈ ਅਤੇ ਤਾਪਮਾਨ ਜ਼ਿਆਦਾ ਵੱਧਦਾ ਨਹੀਂ ਹੈ ਅਤੇ ਨਾ ਹੀ ਜ਼ਿਆਦਾ ਘੱਟਦਾ ਹੈ ਅਤੇ ਇਸ ਦਾ ਕਾਰਨ ਦੱਖਣੀ ਅਤੇ ਉੱਤਰੀ ਭਾਰਤ ਦੀ ਵੱਖੋ ਵੱਖਰੀ ਭੂਗੋਲਿਕ ਸਥਿਤੀ ਹੈ ਅਤੇ ਇਹਨਾਂ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇਹਨਾਂ ਦੇ ਖਾਣ ਪੀਣ ਵਿੱਚ ਵੀ ਕਈ ਤਰ੍ਹਾਂ ਦੇ ਅੰਤਰ ਦੇਖਣ ਨੂੰ ਮਿਲਦੇ ਹਨ ਜਿਵੇਂ ਉੱਤਰੀ ਭਾਰਤ ਦੇ ਵਿੱਚ ਆਟੇ ਦੀ ਰੋਟੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਉੱਥੇ ਹੀ ਦੱਖਣੀ ਭਾਰਤ ਦੇ ਵਿੱਚ ਮੱਛੀ ਅਤੇ ਚੌਲਾਂ ਦਾ ਜ਼ ਸੇਵਨ ਵਧੇਰੇ ਕੀਤਾ ਜਾਂਦਾ ਹੈ ਉੱਤਰੀ ਭਾਰਤ ਦੇ ਵਿੱਚ ਕਿਉਂਕਿ ਕਣਕ ਅਤੇ ਝੋਨਾ ਵੱਡੇ ਲੈਵਲ 'ਤੇ ਉਗਾਏ ਜਾਂਦੇ ਨੇ ਹਾਲਾਂਕਿ ਦੱਖਣੀ ਭਾਰਤ ਦੇ ਵਿੱਚ ਕਣਕ ਅਤੇ ਝੋਨਾ ਬਹੁਤ ਹੀ ਛੋਟੇ ਲੈਵਲ 'ਤੇ ਉਗਾਏ ਜਾਂਦੇ ਹਨ